ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲ ਰਹੇ ਹਾਂ ਜੀ ਜੀ ਓਕੇ ਕਿਹੜਾ ਜੀ ਦੱਸੋ ਸਾਡੇ ਕੋਲ ਸਾਰੇ ਈ ਹੈ ਮੋਡਲ ਜੀ ਸਾਰੇ ਕੰਪਨੀ ਦੇ ਹੈ ਲਗਭਗ ਓਪੋ ਏ ਆਏ ਆਪਣੀ ਹੈ ਵੀਵੋ ਹੈ ਸੈਮਸੰਗ ਹੈ ਆਈ ਫੋਨ ਨੇ ਨੋਕੀਆ ਹੈ ਸਾਰੇ ਮਿਲ ਜਾਣਗੇ ਜੀ ਜੀ

ਫਿਲਹਾਲ ਤਾਂ ਜੀ ਲੇਟੈਸਟ ਆਈ ਫੋਨ ਫਿਫਟੀਂਨ ਆਇਆ ਅਤੇ ਇਸ ਤੋਂ ਇਲਾਵਾ ਆਈ ਫੋਨ ਫਿਫਟੀਂਨ ਹਾਂਜੀ ਉਹ ਆਪਣੇ ਕੋਲ ਜਿਹੜੇ ਹੈ ਸ ਕਈ ਕਲਰ 'ਚ ਮਿਲ ਜਾਏਗਾ ਅਤੇ ਸਟੋਰੇਜ ਉਹਦੀ ਆਪਾਂ ਨੂੰ ਚੋਹਟ ਜੀ ਬੀ ਇਕ ਸੌ ਅਠਾਈ ਜੀ ਬੀ ਦੋ ਸੋ ਛਪੰਜਾ ਜੀ ਬੀ ਸਾਰੇ ਮਿਲ ਜਾਣਗੇ ਜੀ ਮੋਡਲ ਉਹਦੇ ਜੀ ਬਾਕੀ ਤੁਸੀਂ ਜੀ ਜੀ ਨਹੀਂ ਦੋਨੇ ਹੋ ਜਾਣਗੇ ਕੈਸ਼ ਕਰਨੇ ਤੁਸੀਂ ਕੈਸ਼ ਕਰ ਸਕਦੇ ਹੋ ਔਨਲਾਈਨ ਕਰਨੇ ਔਨਲਾਈਨ ਤੁਹਾਡੇ ਕੋਲ ਬਜਾਜ ਕਾਰਡ ਬਣਿਆ ਹੋਇਆ ਜੀ ਬਜਾਜ ਕਾਰਡ ਹੈ ਤੁਹਾਡੇ ਕੋਲ ਓਕੇ ਕੋਈ ਗੱਲ ਨਹੀਂ ਉਹਨਾਂ ਦੇ ਨਾਮ 'ਤੇ ਵੀ ਤੁਸੀਂ ਪਟਿਆਲੇ ਤੋਂ ਹੀ ਹੋ ਠੀਕ ਹੈ ਫਿਰ ਕੋਈ ਈਸ਼ੂ ਨਹੀਂ ਹੈਗਾ ਜੀ ਉਸ ਕਾਰਡ 'ਤੇ ਵੀ ਹੋ ਜਾਏਗਾ ਅਤੇ ਕੋਈ ਇਸ਼ੂ ਨਹੀਂ ਇਹਦਾ ਬਸ ਤੁਸੀਂ ਕਾਰਡ ਲੈ ਕੇ ਆ ਜਾਓ ਡਾਊਨ ਪੇਮੈਂਟ ਜਿੰਨੀ ਕਰਨੀ ਕਰ ਸਕਦੇ ਜੇ ਨਹੀਂ ਵੀ ਕਰਨੀ ਫਿਰ ਵੀ ਕੋਈ ਚੱਕਰ ਨਹੀਂ ਜੀ ਤੁਸੀਂ ਬਸ ਆਪਣਾ ਜਿਹੜਾ ਹੈ ਆ ਜਾਓ ਜੇ ਤੁਹਾਡਾ ਹੈ ਬਜਾਜ ਕਾਰਡ ਬਣਿਆ ਹੋਇਆ ਸਾਡੀ ਹੁੰਦੀ ਆ ਜੀ ਸ਼ਾਮ ਨੂੰ ਰਾਤ ਨੂੰ ਨੌ ਕੁ ਵਜੇ ਤੱਕ ਹੁੰਦੀ ਹੈ ਜੀ ਸੁਬਹਾ ਪਰ ਅਸੀਂ ਲੇਟ ਆਉਣਾ ਜੀ ਸੁਬਹਾ ਨੌ ਦਸ ਵਜੇ ਆਉਂਦੇ ਹਾਂ ਸੁਬਹਾ ਜਲਦੀ ਨਹੀਂ ਆਉਂਦੇ ਦਸ ਵੱਜ ਜਾਂਦੇ ਆ ਕੋਈ ਗੱਲ ਨਹੀਂ ਜੀ ਤੁਸੀਂ ਆ ਜਾਇਓ ਤੁਹਾਨੂੰ ਐਡਰੈਸ ਪਤਾ ਹੀ ਹੋਵੇਗਾ ਆਪਣਾ ਹੈ ਨਾ ਲੀਲਾ ਭਵਨ 'ਚ ਹੈ ਜੀ ਹਾਂਜੀ ਹਾਂਜੀ ਹਾਂਜੀ ਜੀ ਜੀ ਮੈਮ ਬਿਲਕੁਲ ਓਕੇ ਮੈਮ ਓਕੇ ਜੀ ਠੀਕ ਹੈ ਮੈਮ ਓਕੇ